ਮੈਂ ਜ਼ਿਆਦਾਤਰ ਧਾਰਮਿਕ ਸਥਾਨਾਂ 'ਤੇ ਜਾਣਾ ਪਸੰਦ ਕਰਦੀ ਹਾਂ ਜਿਵੇਂ ਕਿ ਚਿੰਤਪੁਰਨੀ ਮੰਦਰ ਤਾ ਹਿਮਾਚਲ ਪ੍ਰਦੇਸ਼ ਵਿੱਚ ਹੈ ਉੱਥੇ ਉਹਦੇ ਲਾਗੇ ਲਾਗੇ ਕਈ ਸਾਰੇ ਮੰਦਰ ਜਿੱਦਾਂ ਕਿ ਚਿੰਤਪੁਰਨੀ ਜਵਾਲਾ ਜੀ ਚਮੰਡਾ ਦੇਵੀ ਨੈਣਾ ਦੇਵੀ ਕਈ ਸਥਾਨ ਨੇ ਕਈ ਧਾਰਮਿਕ ਜਗ੍ਹਾ ਨੇ ਮੈਂ ਮੇਰੀ ਦਿਲਚਸਪੀ ਜ਼ਿਆਦਾਤਰ ਮ ਮੰਦਰ ਧਾਰਮਿਕ ਸਥਾਨਾਂ 'ਤੇ ਜਾਣ ਦੀ ਹੁੰਦੀ ਏ ਜਦੋਂ ਵੀ ਸਾਨੂੰ ਸਾਲ ਦੇ ਵਿੱਚ ਇੱਕ ਅੱਧੀ ਵਾਰ ਮੌਕਾ ਤਾਂ ਮਿਲ ਹੀ ਜਾਂਦਾ ਪਰਮਾਤਮਾ ਦਰਸ਼ਨ ਕਰਨ ਵਾਸਤੇ ਮਾਤਾ ਰਾਣੀ ਸਾਨੂੰ ਸੱਦ ਹੀ ਲੈਂਦੀ ਹੈ ਅਸੀਂ ਉੱਥੇ ਜਾਣਾ ਪਸੰਦ ਕਰਦੇ ਹਾਂ ਤਾਂ ਕਿ ਸਾਡੇ ਮਨ ਨੂੰ ਸ਼ਾਂਤੀ ਸਕੂਨ ਬਹੁਤ ਮਿਲਦਾ ਹੈ ਉੱਥੇ ਜਾ ਕੇ ਮਾਂ ਦੇ ਦਰਸ਼ਨ ਕਰਕੇ ਕਈ ਵੈਸ਼ਨੋ ਦੇਵੀ ਜਾਂਦੇ ਹਾਂ ਉੱਥੇ ਜਾ ਕੇ ਬੜੀ ਸੰਤੁਸ਼ਟੀ ਆਉਂਦੀ ਏ ਇਸੇ ਤਰ੍ਹਾਂ ਕਈ ਸਥਾਨ ਨੇ ਧਾਰਮਿਕ ਜਗ੍ਹਾ ਨੇ ਮੰਦਰ ਨੇ ਅਤੇ ਜਿੱਥੇ ਵੀ ਜਾਣ ਲੱਗ ਗੁਰਦੁਆਰੇ ਵੀ ਹੁਣ ਅਸੀਂ ਉੱਥੇ ਵੀ ਚਲ ਜਾਂਦੇ ਹਾਂ ਵੱਖ ਵੱਖ ਤਰ੍ਹਾਂ ਦੇ ਧਾਰਮਿਕ ਅਸਥਾਨ 'ਤੇ ਜਾ ਕੇ ਮਨ ਨੂੰ ਸ਼ਾਂਤੀ ਬਹੁਤ ਸਕੂਨ ਭਰਿਆ ਆਨੰਦ ਆਉਂਦਾ ਹੈ